ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੇਖੋ ਇੱਕ ਤਾਂ ਨਾ ਗੋਲਾ ਗਾ ਅੰਡਰ ਅੰਡਰ ਚੌਦਾਂ ਵੀ ਅੰਡਰ ਸਤਾਰਾਂ ਅੰਡਰ ਉੱਨੀ ਤਿੰਨ ਅ ਮਤਲਬ ਤਿੰਨ ਉਮਰਾਂ ਦੀਆਂ ਉਹ 'ਚ ਕੀਤਾ ਹੋਇਆ ਅਤੇ ਲੌਂਗ ਜੰਪ ਹੈਗਾ ਗਾ ਹਾਈ ਜੰਪ ਹੈ ਹੈ ਨਾ ਸੌ ਮੀਟਰ ਦੀ ਰੇਸ ਆ ਦੋ ਸੌ ਮੀਟਰ ਦੀ ਰੇਸ ਆ ਰਿਲੇਅ ਰੇਸ ਆ ਇੱਦਾਂ ਦੇ ਇਵੈਂਟਸ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਕੋਈ ਗੱਲ ਨਹੀਂ ਇਹ ਜਿਹੜਾ ਈਵੈਂਟ ਹੈ ਇਹ ਆਪਣਾ ਹੋਏਗਾ ਜੀ ਅਠਾਈ ਤਰੀਕ ਨੂੰ ਅਠਾਈ ਸਤੰਬਰ ਨੂੰ ਹਾਂਜੀ ਪ੍ਰੈਕਟਿਸ ਹਾਂਜੀ ਕੋਈ ਗੱਲ ਨਹੀਂ ਸਕੂਲ 'ਚ ਹੈ ਨਾ ਪੀਰੀਅਡ ਅਲੱਗ ਤੋਂ ਅਲਾਓ ਕੀਤਾ ਹੋਇਆ ਗੇਮ ਪੀਰੀਅਡ ਉਹਦੇ ਵਿੱਚ ਕਰ ਲੈਣਗੇ ਹਾਂਜੀ ਨਹੀਂ ਨਹੀਂ ਜੀ ਕੋਈ ਫੀਸ ਨਹੀਂ ਹੈਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਵਧੀਆ ਕਰਦੀ ਹੈ ਜੀ ਉਹ 'ਚ ਵਧੀਆ ਕਰਦੀ ਹੈ ਜੀ ਉਹ 'ਚ ਹਾਂਜੀ ਪੜ ਹਾਂਜੀ ਵਧੀਆ ਪੜ੍ਹਦੀ ਆ ਜੀ

ਹਾਂਜੀ ਹਾਂਜੀ ਵਧੀਆ ਭਾਗ ਲੈਂਦੀ ਹੈ ਗੋਲਾ ਰਿਲੇਅ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਜ਼ਰੂਰ ਕੋਈ ਗੱਲ ਨਹੀਂ ਅਸੀਂ ਜ਼ਰੂਰ ਲਵਾ ਲਗਾਵਾਂਗੇ ਜੀ ਬੱਚੇ ਦੀ ਜੇ ਇੱਛਾ ਹੈਗੀ ਆ ਅਸੀਂ ਜ਼ਰੂਰ ਲਗਵਾਵਾਂਗੇ ਹਾਂਜੀ ਓਕੇ ਓਕੇ ਜੀ